ਹਾਂਜੀ ਮੈਂ ਘਰ ਵਿੱਚ ਬਹੁਤ ਕਿਸਮ ਦੇ ਪੌਦੇ ਦੀਆਂ ਵੇਲਾਂ ਲਗਾਈਆਂ ਹੋਈਆਂ ਹਨ ਜਿਵੇਂ ਸਭ ਤੋਂ ਪਹਿਲਾਂ ਸਬਜ਼ੀਆਂ ਦੀਆਂ ਵੇਲਾਂ ਜਿਹਦੇ ਵਿੱਚ ਕਰੇਲਿਆਂ ਦੀ ਵੇਲ ਕੱਦੂ ਦੀ ਵੇਲ ਹੋਰ ਵੀ ਬਹੁਤ ਸਾਰੀਆਂ ਵੇਲਾਂ ਆਉਂਦੀਆਂ ਨੇ ਤੋਰੀਆਂ ਕਾਲੀ ਤੋਰੀ ਦੀ ਵੇਲ ਉਹ ਮੈਂ ਘਰ ਵਿੱਚ ਲਗਾਈਆਂ ਹੋਈਆਂ ਨੇ ਜਿਨ੍ਹਾਂ ਦਾ ਮੈਂ ਬਹੁਤ ਦੇਖ ਰੇਖ ਕਰਦੀ ਹਾਂ ਅਤੇ ਇਹ ਬਹੁਤ ਹੀ ਲਾਭਦਾਇਕ ਵੀ ਹੁੰਦੀਆਂ ਨੇ ਇਹ ਬਾਜ਼ਾਰ ਤੋਂ ਮਿਲਣ ਨਾਲੋਂ ਜ਼ਿਆਦਾ ਵਧੀਆ ਘਰਦੀਆਂ ਲੱਗੀਆਂ ਹੋਈਆਂ ਹੁੰਦੀਆਂ ਹਨ ਇਸ ਤੋਂ ਬਾਅਦ ਆਉਂਦੀਆ ਫਲਾਂ ਦੀਆਂ ਵੇਲਾਂ ਜਿੱਦਾਂ ਅੰਗੂਰਾਂ ਦੀ ਵੇਲ ਹੋਰ ਵੀ ਬਹੁਤ ਸਾਰੀਆਂ ਵੇਲਾਂ ਇਹਦੇ ਵਿੱਚ ਉਹ ਵੀ ਮੈਂ ਘਰ ਵਿੱਚ ਲਗਾਈਆਂ ਹੋਈਆਂ ਹਨ ਅਤੇ ਮੈਂ ਬਹੁਤ ਜ਼ਿਆਦਾ ਇਹਨਾਂ ਦੀ ਦੇਖ ਰੇਖ ਕਰਦੀ ਹਾਂ ਅਤੇ ਆਪਣੇ ਘਰ ਦੇ ਫਲ ਹੀ ਖਾਂਦੀ ਆਂ ਜ਼ਿਆਦਾਤਰ ਬਾਅਦ ਵਿੱਚ ਆਉਂਦਾ ਹੈ ਪੌਦੇ ਦੀ ਵੇਲ ਇਹਦੇ ਵਿੱਚ ਵੀ ਬਹੁਤ ਸਾਰੀਆਂ ਵੇਲਾਂ ਆਉਂਦੀਆਂ ਨੇ ਨਿੰਬੂ ਦੀ ਵੇਲ ਅੰਬਾ ਦੀ ਵੇਲ ਹੋਰ ਵੀ ਬਹੁਤ ਸਾਰੀਆਂ ਵੇਲਾਂ ਹੈ ਜੋ ਪੌਦੇ ਵਿੱਚ ਆਉਂਦੀਆਂ ਨੇ ਮੈਂ ਆਪਣੇ ਘਰ ਵਿੱਚ ਬਹੁਤ ਵੱਡਾ ਬਗੀਚਾ ਹੈ ਮੇਰੇ ਘਰ ਵਿੱਚ ਜਿਹਦੀ ਮੈਂ ਬਹੁਤ ਦੇਖ ਰੇਖ ਕਰਦੀ ਹਾਂ ਔਰ ਮੈਂ ਉਹਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਰੱਖਦੀ ਹਾਂ ਸਾਫ਼ ਸੁਥਰਾ ਰੱਖਦੀ ਹਾਂ ਅਤੇ ਮੈਨੂੰ ਬਹੁਤ ਅੱਛਾ ਵੀ ਲੱਗਦਾ ਉਹਨੂੰ ਦੇਖ ਕੇ ਕਿ ਮੇਰੇ ਘਰ ਵਿੱਚ ਬਹੁਤ ਹਰਿਆ ਭਰਿਆ ਇੱਕ ਬਗੀਚਾ ਹੈ ਧੰਨਵਾਦ